ਭਾਰਤ ਵਿੱਚ ਪਿਛਲੇ ਕੁਝ ਦਹਾਕਿਆਂ ਤੋਂ ਕਈ ਤਰ੍ਹਾਂ ਦੀਆਂ ਨਵੀਆਂ ਨੌਕਰੀਆਂ ਪੈਦਾ ਹੋਈਆਂ ਆ ਜਿਵੇਂ ਯੂਟੂਬਰ ਦੇ ਉੱਤੇ ਆਪਣੀਆਂ ਵੀਡੀਓ ਬਣਾ ਕੇ ਉਹ ਲੋਕਾਂ ਨੂੰ ਹਸਾਇਆ ਜਾਂਦਾ ਹੈ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣਿਆ ਜਾਂਦਾ ਹੈ ਯੂਟੂਬ ਉੱਤੇ ਆਪਣੀ ਰੀਲ ਬਣਾ ਕੇ ਲੋਕਾਂ ਨੂੰ ਹਸਾਉਣ ਅਤੇ ਉਹਨਾਂ ਦਾ ਮਨੋਰੰਜਨ ਕਰਨ ਦਾ ਸਾਧਨ ਬਣ ਗਿਆ ਆ ਉਸ ਮੁਤਾਬਕ ਲੋਕਾਂ ਨੇ ਉਸ ਤੋਂ ਪੈਸੇ ਕਮਾਉਣ ਦਾ ਸਾਧਨ ਬਣਾ ਲਿਆ ਆ ਅਤੇ ਯੂਟੂਬ ਤੋਂ ਆਹੀ ਕੋਈ ਵੀ ਵੀਡੀਓ ਜਾਂ ਰੀਲ ਬਣਾ ਕੇ ਪੈਸੇ ਕਮਾ ਸਕਦੇ ਹਾਂ ਇਸ ਤਰ੍ਹਾਂ ਹੀ ਕਪਿਲ ਸ਼ਰਮਾ ਨੇ ਵੀ ਕਮੇਡੀਅਨ ਦੇ ਵਿੱਚ ਆਪਣੇ ਭਾਰਤ ਵਿੱਚ ਨਹੀਂ ਸਮਾਂ ਕਿ ਵਿਸ਼ਵ ਦੇ ਵਿੱਚ ਆਪਣੇ ਇੱਕ ਅਲੱਗ ਇਮੇਜ਼ ਸਥਾਪਿਤ ਕੀਤੀ ਆ ਜਿਸ ਦੇ ਵਿੱਚ ਉਹਨੇ ਆਪਣੇ ਆਪ ਨੂੰ ਇੱਕ ਉਭ ਉਭਰਨ ਉਭਰਦਾ ਹੋਇਆ ਸਿਤਾਰਾ ਬਣਿਆ ਹੈ ਉਸਨੇ ਹੁਣ ਲੋਕਾਂ ਦੇ ਮਨਾਂ 'ਤੇ ਰਾਜ ਕਰਨ ਵਾਲਾ ਕਮੇਡੀਅਨ ਕਪਿਲ ਸ਼ਰਮਾ ਬਣ ਗਿਆ ਆ ਉਹ ਫਿਲਮ ਫਿਲਮੀ ਐਕਟਰ ਅਤੇ ਹੋਰ ਸਮ ਨਿਰਮਾਤਾਵਾਂ ਦਾ ਚਹੇਤਾ ਬਣ ਗਿਆ ਆ ਉਸਨੇ ਇਸ ਪੱਖ ਵਿੱਚ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਔਰ ਅੱਜ ਕੱਲ੍ਹ ਲੋਕ ਜਾਂ ਨੌਜਵਾਨ ਇਹ ਚਾਹੁੰਦੇ ਆ ਕਿ ਉਹਨਾਂ ਦੀ ਜ਼ਿੰਦਗੀ ਆਰਾਮਦਾਇਕ ਹੋਵੇ ਅਗਰ ਜੇ ਕੋਈ ਸਲਿੰਮ ਟਰਿੰਮ ਕੋਈ ਬੱਚਾ ਆ ਤਾਂ ਉਹ ਚਾਹੁੰਦਾ ਆ ਕਿ ਮੈਂ ਆਰਮੀ ਦੇ ਵ ਆਰਮੀ ਜੁਆਇਨ ਕਰਾਂ ਅਤੇ ਦੇਸ਼ ਦੀ ਰੱਖਿਆ ਕਰਾਂ ਜਿਸ ਜਿਸ ਤਰ੍ਹਾਂ ਦਾ ਸਰੀਰ ਹੈ ਉਸ ਉਸ ਤਰ੍ਹਾਂ ਦੀਆਂ ਨੌਕਰੀਆਂ ਦੀ ਭਾਲ ਕਰਦੇ ਆ ਅਗਰ ਕੋਈ ਹੈਵੀ ਜਾਂ ਕੋਈ ਸਿਹਤਮੰਦ ਨਹੀਂ ਉਹ ਚਾਹੁੰਦਾ ਆ ਕਿ ਮੈਂ ਕੁਰਸੀ 'ਤੇ ਬੈਠ ਕੇ ਨੌਕਰੀ ਕਰਾਂ ਅਤੇ ਇਹੀ ਆ ਕਿ ਅੱਜ ਕੱਲ੍ਹ ਬਦਲਾਉ ਆ ਗਿਆ ਆ ਨਵੀਆਂ ਨੌਕਰੀਆਂ ਨਵੇਂ ਲੋਕਾਂ ਦੇ ਵਿਚਾਰ ਉਸ ਵਿੱਚ ਸ਼ਾਮਿਲ ਹਨ